ਅਸੀਂ ਆਪਣੇ ਇਲਾਕੇ ਦੇ ਵਿੱਚ ਸਾਫ਼ ਸਫ਼ਾਈ ਦਾ ਬਹੁਤ ਧਿਆਨ ਰੱਖਦੇ ਐਂ ਜਿਵੇਂ ਕਿ ਸੜਕ ਦੇ ਵਿੱਚ ਪਾਣੀ ਖੜ੍ਹ ਜਾਣਾ ਉਹਨੂੰ ਡਿਸਪਰਸ ਕਰਨਾ ਜਾਂ ਉੱਥੇ ਮੱਛਰ ਦੀ ਦਵਾਈ ਗੇਰਣੀ ਅਤੇ ਐੱਮ ਸੀ ਤੋਂ ਮੱਛਰ ਦੀ ਦਵਾਈ ਦੇ ਬਾਰੇ ਫ਼ੋਨ ਕਰਕੇ ਬੁਲਾਉਣਾ ਅਤੇ ਹੋਰ ਜਿਵੇਂ ਪਾਰਕ ਦੇ ਵਿੱਚ ਘਾਹ ਹੋ ਜਾਂਦਾ ਉੱਥੇ ਐੱਮ ਸੀ ਵਾਲ਼ਿਆਂ ਨੂੰ ਫ਼ੋਨ ਕਰਕੇ ਕਿ ਉਸ 'ਚ ਭਾਵੇਂ ਠੇਕੇਦਾਰ ਆ ਭਾਵੇਂ ਕੋਈ ਆ ਉਹ ਨਾਲ਼ ਲੱਗ ਕੇ ਉਹ ਸਫ਼ਾਈ ਕਰਵਾਉਣੀ ਅਤੇ ਹੋਰ ਵੀ ਜੋ ਕੁਛ ਵੀ ਅਗਰ ਕੋਈ ਕੁੱਤਾ ਲੈ ਕੇ ਵੀ ਘੁੰਮ ਰਿਹਾ ਤਾਂ ਉਹਨੂੰ ਉਹਨੂੰ ਮਨਾ ਕਰਨਾ ਵੀ ਪਾਰਕ ਦੇ ਵਿੱਚ ਕੁੱਤਾ ਨਹੀਂ ਲੈ ਕੇ ਜਾਣਾ ਕਿਉਂਕਿ ਕੁੱਤਾ ਜਿੱਥੇ ਘੁੰਮੇਗਾ ਉੱਥੇ ਗੰਦ ਤਾਂ ਪਵੇਗਾ ਹੀ ਬਾਕੀ ਹੋਰ ਵੀ ਇਲਾਕੇ ਦੀ ਸਫ਼ਾਈ ਦੇ ਵਿੱਚ ਮੈਂ ਖੁਦ ਖੜ੍ਹ ਕੇ ਨਾਲ਼ ਕੰਮ ਕਰਵਾਉਣਾ ਕੋਈ ਕੋਈ ਗੱਲ ਨਹੀਂ ਜੇ ਆਪਾਂ ਨੂੰ ਵੀ ਕਹੀ ਲੈ ਕੇ ਘੁੰਮਣਾ ਪਵੇਗਾ ਤਾਂ ਕੋਈ ਇਹਦੇ ਵਿੱਚ ਕੋਈ ਬੜੀ ਗੱਲ ਨਹੀਂ